ਮੈਨੂੰ ਵੈਸੇ ਸਰਫਿੰਗ 'ਚ ਜ਼ਿਆਦਾ ਇੰਟਰਸਟ ਨਹੀਂ ਸੀ ਪਰ ਮੈਂ ਆਪਣੇ ਦੋਸਤਾਂ ਨਾਲ ਗਈ ਅਤੇ ਜਦੋਂ ਉਹਨਾਂ ਨੂੰ ਇੱਦਾਂ ਸਰਫਿੰਗ ਕਰਦੇ ਦੇਖਿਆ ਤਾਂ ਮੈਨੂੰ ਵੀ ਦਿਲ ਕੀਤਾ ਕਿ ਮੈਂ ਵੀ ਉਹ ਸਰਫਿੰਗ ਦੇ ਵਿੱਚ ਜਾਵਾਂ